ਪੰਜਾਬ ਵਿੱਚ ਮਨੋਰੰਜਨ ਗਤੀਵਿਧੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਜਿਵੇਂ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਕਬੱਡੀ ਬਹੁਤ ਜ਼ਿਆਦਾ ਮਸ਼ਹੂਰ ਹੈ ਪੰਜਾਬ ਦੇ ਜਿਹੜੇ ਨੌਜਵਾਨ ਹੈ ਕਬੱਡੀ ਖੇਡਣ 'ਚ ਫੁੱਟਬਾਲ ਖੇਡਣ 'ਚ ਬਹੁਤ ਜ਼ਿਆਦਾ ਮਨੋਰੰਜਨ ਕਰਦੇ ਹੈ ਅਤੇ ਅੱਜ ਕੱਲ੍ਹ ਜ਼ਿਆਦਾਤਰ ਜਿਹੜੇ ਲੋਕ ਹੈ ਉਹ ਕ੍ਰਿਕਟ ਵੱਲ ਨੂੰ ਹੋ ਤੁਰੇ ਹੈ ਜਿਹੜੀ ਕਿ ਬਾਹਰਲ਼ੇ ਲੋਕਾਂ ਦੀ ਕ੍ਰ ਖੇਡ ਹੈ ਪਰ ਸਾਨੂੰ ਪੰਜਾਬੀ ਵਿੱਚ ਰਹਿੰਦੇ ਹੋਏ ਕਬੱਡੀ ਅਤੇ ਆਪਣੀਆਂ ਖੇਡਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਵਧਾਉਣਾ ਚਾਹੀਦਾ ਹੈ